ਹੈਲੋ ਤੁਸੀਂ ਕਿੱਥੋਂ ਸੋਪ ਤੋਂ ਬੋਲਦੇ ਓ ਇਸ ਚੀਜ਼ ਦੀ ਸ਼ੋਪ ਹੈ ਅੱਛਾ ਅੱਛਾ ਠੀਕ ਐ ਮੇਰਾ ਬੇਟਾ ਬਾਰਵੀਂ ਜਮਾਤ ਚ ਪੜਦਾ ਐ ਤੇ ਉਹਦੇ ਵਾਸਤੇ ਕਿਤਾਬਾਂ ਚਾਹੀਦੀ ਕੁਛ ਹਿੰਦੀ ਇੰਗਲਿਸ਼ ਪੰਜਾਬੀ ਐਸ ਐਸ ਅੱਛਾ ਅੱਛਾ ਅੱਛਾ ਡਿਸਕਾਊਂਟ ਕੀ ਦੋਗੇ ਆਪ ਕਿੰਨਾ ਅੱਛਾ ਤੇ ਚਾਲੀ ਪ੍ਰਸੈਂਟ ਨੀ ਦੋਗੇ ਚਾਲੀ ਪ੍ਰਸੈਂਟ ਦੇ ਦੋ ਅੱਛਾ ਸੋ ਸ਼ੋਪ ਕਿਧਰ ਐ ਅੱਛਾ ਅੱਛਾ ਅੱਛਾ ਸ਼ੋਪ ਦਾ ਕੀ ਕੀ ਨਾਂ ਹੈ ਅੱਛਾ ਅੱਛਾ ਅੱਛਾ ਅੱਛਾ ਸ਼ਾਮ ਨੂੰ ਕਿੰਨੇ ਟਾਈਮ ਤੱਕ ਹੁੰਦੇ ਹੋ ਤੁਸੀਂ ਅੱਛਾ ਅੱਛਾ ਤੇ ਅੱਛਾ ਪੰਜਾਬੀ ਇੰਗਲਿਸ਼ ਸਾਇੰਸ ਮੈਥ ਆਛਾ ਤੇ ਚਲੋ ਮੈਂ ਆ ਕੇ ਸ਼ਾਮ ਨੂੰ ਲੈਨੇ ਆਕੇ ਤੇ ਹੋਰ ਸਾਮਾਨ ਸਾਰਾ ਮਿਲਦਾ ਸਮਾਨ ਬਾਕੀ ਪੈੱਨ ਸ਼ੋਪਨਰ ਅੱਛਾ ਅੱਛਾ ਚਲੋ ਠੀਕ ਹੈ ਚਲੋ ਓਕੇ